ਜਿੰਨੇ ਸਾਡੇ ਸਕੂਲ ਦੇ ਵਿਦਿਆਰਥੀ ਹਨ ਉਹਨਾਂ ਵਿੱਚ ਕਈ ਵਿਦਿਆਰਥੀ ਇੱਦਾਂ ਕਿ ਉਹ ਦੌੜਨ ਦੀ ਬਹੁਤ ਹੀ ਵਧੀਆ ਕ ਕੋਸ਼ਿਸ਼ ਕਰਦੇ ਹਾਂ ਅਤੇ ਅੱਗੇ ਕਈ ਕੰਪਟੀਸ਼ਨ ਕਰਦੇ ਹਨ ਜਿਹਨਾਂ ਵਿੱਚ ਕਈ ਤਾਂ ਨੈਸ਼ਨਲ ਵੀ ਸਟੇਟ ਵੀ ਖੇਲ ਚੁੱਕੇ ਹਨ ਇਹਨਾਂ ਵਿੱਚ ਇੱਦਾਂ ਹੈ ਕਿ ਸਾਡੇ ਸਾਡੇ ਜਿੰਨੇ ਓਲੰਪਿਕ ਵੀ ਆਉਂਦੇ ਹਨ ਐਥਲੀਟ ਵਗੈਰਾ ਜਿੰਨੇ ਵਿੱਚ ਹੈ ਉਹ ਇਹਨਾਂ ਵਿੱਚੋਂ ਨਿਕਲ ਕੇ ਆਉਂਦਾ ਅੱਗੇ ਅੱਗੇ ਨਿਕਲਦੇ ਹਨ ਇਸ ਲਈ ਸਾਡੇ ਸਕੂਲ ਵਿੱਚ ਸਮੇਂ ਸਮੇਂ ਸਿਰ ਦੌੜਾਂ ਵੀ ਕਰਾਈਆਂ ਜਾਂਦੀਆਂ ਹਨ ਜਿਹਨਾਂ ਵਿੱਚੋਂ ਕਿ ਬੱਚੇ ਨਿਕਲਦੇ ਹਨ ਅੱਗੇ ਆਉਂਦੇ ਹਨ ਅਤੇ ਉਹਨਾਂ ਤੋਂ ਬਾਅਦ ਸਟੇਟ ਲੈਵਲ ਹੁੰਦਾ ਅਤੇ ਉਹਦੇ ਨੈਸ਼ਨਲ ਲੈਵਲ ਹੁੰਦਾ ਹੈ ਜਿਸ ਨਾਲ ਕਿ ਇੱਦਾਂ ਕਿ ਬੱਚਿਆਂ ਬੱਚਿਆਂ ਦਾ ਨਸ਼ਿਆਂ ਵੱਲੋਂ ਵੀ ਮਨ ਭਟਕ ਜਾਂਦਾ ਹੈ ਅਤੇ ਬੱਚੇ ਨਸ਼ੇ ਕਰਨ ਨਹੀਂ ਕਰਦੇ ਅਤੇ ਸਾਡੇ ਦੇਸ਼ ਨੂੰ ਵਧੀਆ ਅਥਲੀਟ ਮਿਲ ਜਾਂਦੇ ਹਨ ਬੱਚਿਆਂ ਦੇ ਇੱਕ ਤਾਂ ਸਿ ਸਿਹਤ ਵਿੱਚ ਵੀ ਵਧੀਆ ਪ੍ਰਭਾਵ ਪੈਂਦਾ ਹੈ ਸਿਹਤ ਅੱਛੀ ਹੁੰਦੀ ਬੱਚਿਆਂ ਦੀ ਠੀਕ ਹੈ ਜਿਸ ਨਾਲ ਕਿ ਉਹਨੂੰ ਮੌਕੇ ਮੌਕੇ ਮੌਕੇ ਸਿਰ ਉਹਨਾਂ ਨੂੰ ਪੜਨੇ ਵਿੱਚ ਵੀ ਵਧੀਆ ਮਨ ਲੱਗਦਾ ਹੈ ਇਸ ਲਈ ਜਿੰਨੇ ਵੀ ਆਪਣੇ ਛੋਟੇ ਬੱਚੇ ਹਨ ਕੋਈ ਵੀ ਛੋਟੇ ਬੱਚੇ ਜਿਹੜੇ ਸਕੂਲ ਵਿੱਚ ਪੜ੍ਹਦੇ ਹਨ ਉਹਨਾਂ ਨੂੰ ਵੱਧ ਤੋਂ ਵੱਧ ਪਰੋਸਾਨ ਕਰੋ ਕਿ ਉਹ ਦੌੜਾਂ ਲਾਉਣ ਠੀਕ ਹੈ ਜਿਸ ਨਾਲ ਕਿ ਸਾ ਸਾਡਾ ਯੂਥ ਹੈ ਉਹ ਨਸ਼ਿਆਂ ਵੱਲੋਂ ਘੱਟ ਤੋਂ ਘੱਟ ਹੋ ਸਕੇ ਅਤੇ ਜਿੰਨੇ ਵੀ ਬੱਚੇ ਹਨ ਉਹ ਕਿੰਨੇ ਵਜੇ ਉਹਨਾਂ ਨੂੰ ਕਹੋ ਕਿ ਦੌੜਾਂ ਲਾਓ ਹੋਰ ਹੋਰ ਐਕਟੀਵਿਟੀਆਂ ਕਰੋ ਜਿਸ ਨਾਲ ਕਿ ਉਹ ਅੱਗੇ ਵੱਧ ਸਕਣ ਆਪਣੇ ਆਪਣੇ ਪਿੰਡ ਦਾ ਆਪਣੇ ਆਪਣੇ ਸ਼ਹਿਰ ਦਾ ਆਪਣੇ ਸਟੇਟ ਦਾ ਆਪਣੇ ਕੰਟਰੀ ਦੇ ਨਾਮ ਰੌਸ਼ਨ ਕਰਨ ਜਿਸ ਨਾਲ ਕਿ ਸਾਡ ਸਾਨੂੰ ਬਹੁਤ ਵਧੀਆ ਸਨਮਾਨ ਮਿਲਦਾ ਹੈ ਅਤੇ ਇੱਕ ਤਾਂ ਬੱਚੇ ਦੌੜ ਲਾ ਕੇ ਬਹੁਤ ਹੀ ਸਿਹਤਮੰਦ ਸਿਹਤਮੰਦ ਰਹਿੰਦੇ ਹਨ ਧੰਨਵਾਦ